ਹਾਂਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਵਧੀਆ ਵਧੀਆ ਸਰ ਜੀ ਵਧੀਆ ਜੀ ਹਾਂਜੀ ਹਾਂਜੀ ਰਿਟੇਲਰ ਸੂ ਰਿਟੇਲਰ ਤੋਂ ਗੱਲ ਕਰ ਰਹੇ ਹਾਂ ਜੀ ਮਿਲ ਜਾਣਗੇ ਸਰ ਮਿਲ ਜਾਣਗੇ ਸਰ ਆਪਣੇ ਕੋਲ ਐਡੀਡਾਸ ਕੰਪਨੀ ਦੇ ਹੈ ਅਤੇ ਨਾਇਕੀ ਦੇ ਹੈਗੇ ਹੈ ਹਾਂਜੀ ਹਾਂਜੀ ਸਾਰੇ ਆ ਜੀ ਲੈਜਰ ਦੇ ਵੀ ਆ ਆਪਣੇ ਕੋਲ ਜਿੰਨੀਆਂ ਵੀ ਕੰਪਨੀਆਂ ਟੋਟਲੀ ਆਪਣੇ ਕੋਲ ਸਾਰੀਆਂ ਇਨਵੋਲਵ ਹੈਗੀਆਂ ਆਪਾਂ ਨੂੰ ਹਰ ਤਰ੍ਹਾਂ ਦੀ ਕੰਪਨੀ ਦਾ ਮਿਲ ਜਾਵੇਗਾ ਹਾਂਜੀ ਸਰ ਸਾਈਜ਼ ਜਿਹੜਾ ਮਰਜੀ ਲਓ ਤੁਸੀਂ ਹਾਂਜੀ ਹਾਂਜੀ

ਮਿਲ ਜਾਣਗੇ ਸਰ ਸੱਤ ਨੰਬਰ ਤਾਂ ਅਵੇਲੇਬਲ ਹੈਗੇ ਆਪਣੇ ਕੋਲ ਮਿਲ ਜਾਣਗੇ ਹਾਂਜੀ ਹਾਂਜੀ ਉਹ ਵੀ ਮਿਲ ਜਾਵੇਗੀ ਸਰ ਚੱਪਲਾਂ ਵੀ ਹੈਗੀਆਂ ਆਪਣੇ ਕੋਲ ਸਰ ਬੂਟ ਵੀ ਹੈਗੇ ਆ ਹਾਂਜੀ ਹਾਂਜੀ ਆਪਣੇ ਕੋਲ ਸਾਰੇ ਕਲਰ ਅਵੇਲੇਬਲ ਹੈਗੇ ਆ ਕਾਫੀ ਤਰ੍ਹਾਂ ਦੇ ਕਲਰ ਹੈਗੇ ਆਪਣੇ ਕੋਲ ਜਿਹੜਾ ਤੁਸੀਂ ਜਿਹੜਾ ਤੁਹਾਨੂੰ

ਹਾਂਜੀ ਹਾਂਜੀ ਉਹ ਵੀ ਸਰ ਆਪਣੇ ਕੋਲ ਮਿਲ ਜਾਊ ਹਾਂਜੀ ਹਾਂਜੀ ਹਾਂਜੀ ਹੈਗੇ ਆ ਸਰ ਆਪਣੇ ਕੋਲ ਮਿਲ ਜਾਣਗੇ ਸਰ ਬਿਨਾ ਫੀਤੇ ਵਾਲੇ ਹਾਂਜੀ ਮਿਲ ਜਾਣਗੇ ਸਰ ਉਹਦਾ ਪ੍ਰਾਈਜ ਸਰ ਆਪਣੇ ਕੋਲ ਸਰ ਢਾਈ ਸੌ ਤੋਂ ਸਟਾਰਟ ਹੁੰਦਾ ਅਤੇ ਅੱਠ ਸੌ ਨੌ ਸੌ ਹਜ਼ਾਰ ਪੰਦਰ੍ਹਾਂ ਸੌ ਉਹ ਉੱਪਰ ਜਿੰਨੇ ਮਰਜ਼ੀ ਲਾਓ ਸਰ ਉਹ ਤੁਸੀਂ ਦੇਖ ਲਿਓ ਜਿਹੜਾ ਤੁਹਾਨੂੰ ਵਧੀਆ ਲੱਗੇਗਾ ਉਹ ਉਸ ਹਿਸਾਬ ਨਾਲ ਆਪਾਂ ਰੇਟ ਡਿਸਕਸ ਕਰ ਦੇਵਾਂਗੇ ਤੁਹਾਨੂੰ ਹਾਂਜੀ ਹਾਂਜੀ ਕੰਪਨੀ ਦੇ ਹਾਂਜੀ ਹਾਂਜੀ ਸਰ ਡਿਸਕਾਊਂਟ ਹੀ ਦੇਵਾਂਗੇ ਸਰ ਪੰਜ ਪਰਸੈਂਟ ਦੇ ਦੇਵਾਂਗੇ ਤੁਹਾਨੂੰ ਜ਼ਿਆਦਾ ਹੋਇਆ ਦਸ ਪਰਸੈਂਟ ਤੱਕ ਦੇ ਦੇਵਾਂਗੇ ਹਾਂਜੀ ਸਰ ਇੱਕ ਆਪਣੇ ਕੋਲ ਬਰੂ ਬੂਟਾਂ ਦੀ ਸਰ ਸਾਰੀ ਵਰਾਇਟੀ ਹੈਗੀ ਆਪਣੇ ਕੋਲ ਤੁਸੀਂ ਆਓ ਇੱਕ ਵਾਰੀ ਵਿਜਿਟ ਕਰੋ ਤੁਹਾਨੂੰ ਸਾਰੀ ਚੀਜ਼ ਦਿਖਾ ਦਿੰਦੇ ਹਾਂ ਜਿਹੜੀ ਜਿਹੜੀ ਚਾਹੀਦੀ ਹੋਈ ਤੁਹਾਨੂੰ ਹਾਂਜੀ ਹਾਂਜੀ ਸਰ ਮਿਲ ਜਾਵੇਗਾ ਮਿਲ ਜਾਵੇਗਾ ਸਰ ਆ ਜਾਉ ਤੁਸੀਂ ਹਾਂਜੀ ਹਾਂਜੀ ਫੁੱਲ ਵਰੰਟੀ ਦੇਵਾਂਗੇ ਸਰ ਠੀਕ ਹੈ ਸਰ ਓਕੇ ਆ ਜਾਓ